ਮੇਰਾ ਘਰ ਇੱਕ ਪਿੰਡ ਵਸ ਰਿਹਾ ਮੇਰਾ ਘਰ ਕਾਫੀ ਖੁੱਲ੍ਹਾ ਹੈ ਅਤੇ ਘਰ ਦੇ ਪਿੱਛੇ ਖਾਲ੍ਹੀ ਜਗ੍ਹਾ ਵੀ ਹੈ ਅਤੇ ਕਾਫੀ ਦਰੱਖਤ ਲੱਗੇ ਹੈ ਅਤੇ ਦਰੱਖਤਾਂ 'ਤੇ ਮੈਂ ਬਾਹਰ ਦੇ ਆਲ੍ਹਣੇ ਟੰਗੇ ਹਨ ਅਤੇ ਉਹਨਾਂ ਨੂੰ ਆ ਕੇ ਬੈਠਦੇ ਹਨ ਉਹਨਾਂ ਦੀਆਂ ਚੀਂ ਚੀਂ ਦੀਆਂ ਆਵਾਜ਼ਾਂ ਆਉਂਦੀਆਂ ਹਨ ਅਤੇ ਸਵੇਰੇ ਵਾਤਾਵਰਨ ਵਿੱਚ ਇਹ ਆਵਾਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਹਨ ਮੈਂ ਆਪਣੇ ਪਕਸ਼ੀਆਂ ਵਾਸਤੇ ਦਾਣਾ ਪਾਣੀ ਰੱਖਦੀ ਹਾਂ ਦਾਣਿਆਂ ਵਿੱਚ ਕਣਕ ਚਾਵਲ ਮੱਕਾ ਅਤੇ ਬਾਜਰਾ ਹੁੰਦਾ ਹੈ ਸਾਡੇ ਘਰ ਵਿੱਚ ਕਬੂਤਰ ਰੋਜ਼ ਆਉਂਦੇ ਹਨ ਅਤੇ ਬਾਹਰ ਮੱਕਾ ਪੀ ਕੇ ਆਨੰਦ ਮਾਣਦੇ ਹਨ ਇੱਕ ਵਾਰ ਮੈਂ ਬਾਹਰ ਗਈ ਇੱਕ ਕਬੂਤਰ ਨੂੰ ਸੱਟ ਲੱਗੀ ਹੋਈ ਸੀ ਜਿਸ ਦੇ ਕਾਰਨ ਉਹ ਉੱਠ ਨਹੀਂ ਸਕਦਾ ਸੀ ਅਸੀਂ ਇਹਨਾਂ ਨੂੰ ਘਰ ਲੈ ਆਏ ਅਤੇ ਮੱਲ੍ਹਮ ਪੱਟੀ ਕੀਤੀ ਦਾਣਾ ਦਿੱਤਾ ਅਤੇ ਉਹ ਠੀਕ ਹੋ ਗਿਆ ਸਾਡੇ ਕੋਲ ਹੀ ਰਹਿੰਦਾ ਹੈ ਕਿਤੇ ਹੋਰ ਨਹੀਂ ਜਾਂਦਾ ਸਾਨੂੰ ਗਰਮੀਆਂ ਦੇ ਮੌਸਮ ਵਿੱਚ ਪਕਸ਼ੀਆਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਗਰਮ ਵਿੱਚ ਪਕਸ਼ੀ ਬਹੁਤ ਮਰਦੇ ਹਨ ਮੈਂ ਪਕਸ਼ੀਆਂ ਨਾਲ ਬਹੁਤ ਪਿਆਰ ਕਰਦੀ ਹਾਂ ਜਿਸ ਲਈ ਹਰ ਵੇਲੇ ਹਰ ਪਕਸ਼ੀਆਂ ਦਾ ਹੀ ਖਿਆਲ ਰੱਖਦੀ ਹਾਂ